ਹੁਣ ਤੱਕ ਮੈਂ ਕਢਾਈਆਂ ਦੇ ਬੜੇ ਡਿਜ਼ਾਇਨ ਕੱਢ ਚੁੱਕੀ ਹਾਂ ਮੈਂ ਛੋਟੇ ਹੁੰਦਿਆਂ ਤੋਂ ਕਢਾਈਆਂ ਕਢਾਈ ਕੱਢਣਾ ਸਿੱਖੀ ਸੀ ਅਤੇ ਪਹਿਲੇ ਬੜੇ ਹੱਥ ਦੇ ਡਿਜ਼ਾਇਨ ਚੱਲਦੇ ਸੀ ਹੱਥ ਦੀ ਕਢਾਈ ਅਤੇ ਵਿੱਚੋਂ ਫਿਰ ਮਸ਼ੀਨੀ ਕਢਾਈਆਂ ਚੱਲਣ ਲੱਗ ਗਈਆਂ ਹੱਥ ਦੀਆਂ ਕਢਾਈਆਂ ਬਿਲਕੁਲ ਬੰਦ ਹੋ ਗਈਆਂ ਫਿਰ ਅਸੀਂ ਮਸ਼ੀਨ 'ਤੇ ਵੀ ਬੜੀਆਂ ਕਢਾਈਆਂ ਕੱਢੀਆਂ ਵਿੱਚ ਜਿਸ ਤਰ੍ਹਾਂ ਡੋਲੀ ਜਾਂਦੀ ਕਿਸੇ ਕੁੜੀ ਦੀ ਉਹ ਵਾਲੇ ਡਿਜ਼ਾਇਨ ਵੀ ਅਸੀਂ ਕੱਢ ਲੈਂਦੇ ਹਾਂ ਸੂਟਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਆਪਣੇ ਕੋਈ ਢੋਲ ਕੋਈ ਨਗਾੜੇ ਐਵੇਂ ਹੀ ਅਸੀਂ ਚੁੰਨੀਆਂ ਦੇ ਉੱਤੇ ਸੂਟਾਂ ਦੇ ਉੱਤੇ ਕਢਾਈਆਂ ਕੱਢ ਲੈਂਦੇ ਹਾਂ ਅਤੇ ਅਸੀਂ ਕੰਡੇ ਦੇ ਉੱਤੇ ਸੂਟ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਉਹ ਕਢਾਈ ਕੱਢਦੇ ਹਾਂ ਚੰਗੀ ਤਰ੍ਹਾਂ ਅਤੇ ਜਿਹੜੇ ਸਾਡੇ ਧਾਗੇ ਵੀ ਹੁੰਦੇ ਨੇ ਉਹ ਬਹੁਤ ਪੱਕੇ ਹੁੰਦੇ ਨੇ ਵਧੀਆ ਕੋਈ ਰੰਗ ਰੁੰਗ ਉਹਨਾਂ ਦਾ ਕੋਈ ਨਹੀਂ ਜਾਂਦਾ ਬਹੁਤ ਵਧੀਆ ਅਸੀਂ ਕਢਾਈਆਂ ਕੱਢਦੇ ਹਾਂ ਅਤੇ ਔਖੇ ਡਿਜ਼ਾਇੰਨ ਵੀ ਅਸੀਂ ਕੱਢ ਲੈਂਦੇ ਹਾ ਹੁਣ ਫਿਰ ਅੱਜ ਕੱਲ੍ਹ ਫਿਰ ਹੱਥ ਦੀ ਕਢਾਈ ਦਾ ਬੜਾ ਰਿਵਾਜ਼ ਹੈ ਅਤੇ ਫੁਲਕਾਰੀ ਦਾ ਡਿਜ਼ਾਇਨ ਤਾਂ ਹਮੇਸ਼ਾ ਹੀ ਚੱਲਦਾ ਰਹਿੰਦਾ ਸਦੀਆਂ ਪੁਰਾਣਾ ਉਹੀ ਡਿਜ਼ਾਇਨ ਅੱਜ ਵੀ ਉਹ ਵਧੀਆ ਲੱਗਦਾ ਮੈਨੂੰ ਫੁਲਕਾਰੀ ਦਾ ਡਿਜ਼ਾਇਨ ਬਹੁਤ ਵਧੀਆ ਲੱਗਦਾ ਅੱਜ ਵੀ ਮੇਰੀ ਮਨ ਪਸੰਦ ਫੁਲਕਾਰੀ ਹੈ ਧੰਨਵਾਦ ਜੀ